ਇੱਕ ਲੱਖ ਵੀਹ ਹਜ਼ਾਰ ਤਿੰਨ ਸੌ ਦਸ ਵੀਹ ਹਜ਼ਾਰ ਸੱਤ ਲੱਖ ਚੁਰਾਸੀ ਹਜ਼ਾਰ ਦੋ ਸੌ ਨੜਿਨਵੇਂ ਪੈਂਤੀ ਸੌ ਵੀਹ ਤਿੰਨ ਸੌ ਪਚਵੰਜਾ ਗਿਆਰ੍ਹਾਂ ਹਜ਼ਾਰ ਇੱਕ ਸੌ ਬਾਈ